ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਬਹੁਤ ਕੁਛ ਹੈ ਮਤਲਬ ਕਿ ਅਸੀਂ ਲਹਿੰਗੇ ਚਰਖੇ ਪੱਖੀਆਂ ਅਤੇ ਪੁਰਾਣੇ ਸੰਦੂਕ ਪਰਾਂਦੇ ਨਾਲੇ ਇਹੋ ਜਿਹੀਆਂ ਚੀਜ਼ਾਂ ਬਹੁਤ ਸੰਭਾਲ ਕੇ ਰੱਖੀਆਂ ਹੋਈਆਂ ਆਪਣੀ ਆਰਟ ਗੈਲਰੀ ਦੇ ਵਿੱਚ ਅਤੇ ਜਿਨ੍ਹਾਂ ਨੂੰ ਅੱਜ ਕੱਲ੍ਹ ਬਾਹਰ ਦੇ ਲੋਕ ਵੀ ਆ ਕੇ ਬਹੁਤ ਉਹਨਾਂ ਦੀ ਪ੍ਰਸੰਸਾ ਕਰਦੇ ਨੇ ਅਤੇ ਅਸੀਂ ਉਹਨਾਂ ਨੂੰ ਅਸੀਂ ਪੁਰਾਣਾ ਵਿਰਸਾ ਆਪਣੇ ਕੋਲ ਬਹੁਤ ਜ਼ਿਆਦਾ ਸੰਭਾਲ ਕੇ ਰੱਖਿਆ ਹੋਇਆ ਹੈਗਾ ਹਾਂਜੀ ਹਾਂਜੀ ਜਦੋਂ ਮਰਜ਼ੀ ਆਓ ਆ ਕੇ ਦੇਖੋ ਤੁਸੀਂ ਵੀ ਉਹਨੂੰ ਅੱਗੇ ਹੋ ਕਰੋ ਚੁਆਇਸ ਕਰੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਾ ਜੀ ਇਹ ਤਾਂ ਸਾਨੂੰ ਇਹਨਾਂ ਚੀਜ਼ਾਂ ਦੀ ਤਾਂ ਬਹੁਤ ਜ਼ਿਆਦਾ ਲੋੜ ਪੈਂਦੀ ਰਹਿੰਦੀ ਹੈ ਜਿਵੇਂ ਅਸੀਂ ਬਹੁਤ ਜਿਵੇਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਜਿਵੇਂ ਕਿ ਪਰਾਂਦੇ ਲਹਿੰਗੇ ਘੱਗਰੇ ਫੁਲਕਾਰੀਆਂ ਵਗੈਰਾ ਇਹ ਚੀਜ਼ਾਂ ਅਸੀਂ ਬਹੁਤ ਜ਼ਿਆਦਾ ਸੰਭਾਲ ਕੇ ਰੱਖੀਆਂ ਹੋਈਆਂ ਅਤੇ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ ਅਤੇ ਅਸੀਂ ਤੁਹਾਡੇ ਕੋਲ ਜ਼ਰੂਰ ਖਰੀਦਣਾ ਚਾਹੋਂਗੇ ਤੁਸੀਂ ਸਾਨੂੰ ਮਿਲੋ ਆ ਕੇ ਅਤੇ ਅਸੀਂ ਤੁਹਾਨੂੰ ਤੁਹਾਡੇ ਤੋਂ ਖਰੀਦਾਂਗੇ ਠੀਕ ਹੈ ਹਾਂਜੀ ਹਾਂਜੀ ਓਕੇ ਜੀ ਓਕੇ